ਵੈਸੇ ਤਾਂ ਬਹੁਤ ਸਾਰੀਆਂ ਕਿਤਾਬਾਂ ਨੇ ਜਿਹੜੀਆਂ ਮੈਂ ਲਗਾਤਾਰ ਪੜ੍ਹਦੀ ਰਹਿੰਦੀ ਹੈਗੀ ਪਰ ਉਹਨਾਂ ਵਿੱਚੋਂ ਕੁਛ ਕਿਤਾਬਾਂ ਨੇ ਜਿਹੜੀਆਂ ਮੇਰੇ ਮਨਪਸੰਦ ਨੇ ਅਤੇ ਮੇਰੀ ਆਪਣੀ ਕਲੈਕਸ਼ਨ ਦੇ ਵਿੱਚ ਰੱਖੀਆਂ ਹੋਈਆਂ ਨੇ ਤਾਂ ਉਹਨਾਂ ਵਿੱਚੋਂ ਇੱਕ ਪੋਏਟਰੀ ਦੀ ਕਿਤਾਬ ਹੈ ਜੜ੍ਹਾਂ ਦੀ ਮਹਿਕ ਮੇਰੇ ਕੋਲ ਇੱਕ ਖਾਸ ਦੋਸਤ ਹੈ ਗੁਰਪ੍ਰੀਤ ਡੋਨੀ ਅੱਜ ਕੱਲ੍ਹ ਉਹ ਐਡਵੋਕੇਟ ਨੇ ਅਤੇ ਉਹਨਾਂ ਦੀ ਲਿਖੀ ਹੋਈ ਇਹ ਕਿਤਾਬ ਹੈਗੀ ਤਾਂ ਉਹਨਾਂ ਨੇ ਜਿਹੜੀਆਂ ਮਤਲਬ ਆਪਣੀ ਜ਼ਿੰਦਗੀ ਦੇ ਵਿੱਚੋਂ ਆਲੇ ਦੁਆਲੇ ਦੇ ਵਿਊ ਨੂੰ ਦੇਖਦੇ ਹੋਏ ਜਾਂ ਆਪਣੇ ਆਪ ਨੂੰ ਦੇਖਦੇ ਹੋਏ ਉਹਨਾਂ ਨੇ ਬਹੁਤ ਸੋਹਣੀਆਂ ਕਵਿਤਾਵਾਂ ਲਿਖੀਆਂ ਨੇ ਅਤੇ ਉਹਨਾਂ ਦੀ ਇੱਕ ਕਵਿਤਾ ਹੈਗੀ ਜਿਹੜੀ ਮੈਨੂੰ ਬਹੁਤ ਸੋਹਣੀ ਲੱਗਦੀ ਹੈਗੀ ਐੱਮ ਬੀ ਏ ਕਰਕੇ ਐੱਮ ਏ ਭਰਤੀ ਉਹਦੇ ਵਿੱਚ ਇੱਕ ਲਾਈਨ ਹੈਗੀ ਮਤਲਬ ਉਹਨਾਂ ਨੇ ਆਪਣੀ ਲਾਈਫ਼ ਦੇ ਵਿੱਚ ਪਹਿਲੇ ਐੱਮ ਬੀ ਏ ਕੀਤੀ ਉਸ ਤੋਂ ਬਾਅਦ ਐੱਮ ਏ ਭਰਤੀ ਮਤਲਬ ਬਹੁਤ ਸੋਹਣੀ ਕਵਿਤਾ ਲੱਗੀ ਸੀਗੀ ਅਤੇ ਇੱਕ ਉਹਨਾਂ ਨੇ ਲਿਖਿਆ ਸੀਗਾ ਵੀ ਆਪ ਲਿਖਾਂਗੇ ਆਪ ਗਾਵਾਂਗੇ ਗਾਣਾ ਸਿੱਧਾ ਸਾਫ਼ ਗਾਵਾਂਗੇ ਲੋਕ ਹ ਮਿਰਜ਼ਾ ਹੀਰ ਨੇ ਗਾਉਂਦੇ ਅਸੀਂ ਆਪਣੇ ਹਾਲਾਤ ਗਾਵਾਂਗੇ ਮਤਲਬ ਬਹੁਤ ਸੋਹਣੀਆਂ ਕਵਿਤਾਵਾਂ ਲਿਖਦੇ ਹੈਗੇ ਉਹ ਇੱਕ ਨੋਵਲ ਹੈ ਰਾਤ ਬਾਕੀ ਹੈ ਜਸਵੰਤ ਕੰਵਲ ਜੀ ਦਾ ਲਿਖਿਆ ਹੋਇਆ ਨਾਵਲ ਆ ਰਾਤ ਬਾਕੀ ਬਹੁਤ ਹੀ ਫੇਮਸ ਆਗਾ ਤਾਂ ਇਹਦੇ ਵਿੱਚ ਇੱਕ ਸੱਚੀ ਘਟਨਾਵਾਂ 'ਤੇ ਅਧਾਰਿਤ ਜਿਹੜਾ ਇਹ ਨਾਵਲ ਲਿਖਿਆ ਹੋਇਆ ਆਗਾ ਇੱਕ ਮੁੰਡਾ ਹੁੰਦਾ ਆਗਾ ਅਤੇ ਇਹ ਇੱਕ ਰੋਮਾਂਟਿਕ ਲਵ ਸਟੋਰੀ ਹੈਗੀ ਮਤਲਬ ਬਹੁਤ ਪ੍ਰਸਿੱਧ ਨਾਵਲ ਆਗਾ ਇਹ ਦੂਜਾ ਨਾਵਲ ਹੈ ਚਾਲੀ ਦਿਨ ਜਿਹੜਾ ਹੁਣੇ ਜੇ ਪਿੱਛੇ ਜੇ ਹੀ ਇੱਕ ਫੇਮਸ ਨੋਵਲ ਹੋਇਆ ਆਗਾ ਨਵੇਂ ਰਾਈਟਰ ਦਾ ਗੁਰਪ੍ਰੀਤ ਧੁੱਗਾ ਜੀ ਦਾ ਲਿਖਿਆ ਹੋਇਆ ਆਗਾ ਅਤੇ ਇਸ ਨਾਵਲ ਦੇ ਵਿੱਚ ਉਹਨਾਂ ਨੇ ਇੱਕ ਮੁੰਡੇ ਦੀ ਦਾਸਤਾਨ ਬਿਆਨ ਕੀਤੀ ਆਗੀ ਮੁੰਡਾ ਹੁੰਦਾ ਆਗਾ ਉਹਦਾ ਫਾਦਰ ਹੈ ਜਿਹੜਾ ਚਾਰ ਪੰਜ ਸਾਲ ਦੀ ਉਮਰ ਦੇ ਵਿੱਚ ਛੱਡ ਕੇ ਉਹਨੂੰ ਚੱਲ ਜਾਂਦਾ ਆਗਾ ਅਤੇ ਜਦੋਂ ਹੀ ਉਹ ਪੰਦਰਾਂ ਸੋਲਾਂ ਸਾਲ ਦੀ ਉਮਰ ਦਾ ਹੁੰਦਾ ਆਗਾ ਤਾਂ ਉਹ ਆਪਣੇ ਫਾਦਰ ਨੂੰ ਲੱਭਣ ਦੇ ਲਈ ਘਰ ਤੋਂ ਬਾਹਰ ਨਿਕਲਦਾ ਆਗਾ ਅਤੇ ਜਿਵੇਂ ਹੀ ਉਹ ਘਰ ਤੋਂ ਬਾਹਰ ਨਿਕਲਦਾ ਉਹਨੂੰ ਘਰ ਤੋਂ ਬਾਹਰ ਨਿਕਲਦੇ ਕਿਹੜੀਆਂ ਕਿਹੜੀਆਂ ਘਟਨਾਵਾਂ ਫੇਸ ਕਰਨੀਆਂ ਪੈ ਰਹੀਆਂ ਨੇ ਜਦੋਂ ਉਹ ਘਰ ਸੀਗਾ ਤਾਂ ਉਹਨੂੰ ਕਿਸੇ ਵੀ ਹਾਲਾਤ ਬਾਰੇ ਪਤਾ ਨਹੀਂ ਸੀਗਾ ਅਤੇ ਬਾਹਰ ਦੇ ਹਾਲਾਤ ਕਿਵੇਂ ਨੇ ਬਾਹਰ ਦੇ ਲੋਕ ਕਿਵੇਂ ਨੇ ਅਤੇ ਜਦੋਂ ਹੀ ਉਹ ਆਪਣੇ ਫਾਦਰ ਨੂੰ ਲੱਭਣ ਦੇ ਲਈ ਘਰ ਤੋਂ ਬਾਹਰ ਨਿਕਲਦਾ ਗਾ ਤਾਂ ਉਹਨੂੰ ਪਤਾ ਲੱਗਦਾ ਵੀ ਅਸਲ 'ਚ ਦੁਨੀਆ ਹੈ ਕੀ ਆ ਘਰ ਤੋਂ ਬਾਹਰ ਜਾ ਕੇ ਤੁਸੀਂ ਵਿਚਰਦੇ ਕਿਵੇਂ ਹੋਊਂਗੇ ਤੁਹਾਨੂੰ ਸਮਾਜ ਬਾਰੇ ਪਤਾ ਲੱਗਦਾ ਗਾ ਕਿਹੜੀਆਂ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਊਂਗੇ ਤੁਹਾਨੂੰ ਉਹਦੇ ਬਾਰੇ ਪਤਾ ਲੱਗਦਾ ਗਾ ਤਾਂ ਇਸ ਤਰੀਕੇ ਦੇ ਨਾਲ ਇਹ ਨੋਵਲ ਨੇ ਜਿਹੜੇ ਮਤਲਬ ਬਹੁਤ ਸੋਹਣਾ ਨੋਵਲ ਆਗਾ ਅਤੇ ਇਸੇ ਤਰੀਕੇ ਦੇ ਨਾਲ ਇੱਕ ਨੋਵਲ ਆਗਾ ਲਹੂ ਦੀ ਲੋਅ ਮਤਲਬ ਇਹ ਵੀ ਇੱਕ ਸੱਚੀ ਘਟਨਾਵਾਂ ਦੇ ਉੱਪਰ ਆਧਾਰਿਤ ਆਗਾ ਅਤੇ ਇਸੇ ਤਰੀਕੇ ਨਾਲ ਹੋਰ ਵੀ ਬਹੁਤ ਸਾਰੇ ਨੋਵਲ ਨੇ ਜਾਂ ਕਵਿਤਾਵਾਂ ਨੇ ਕਹਾਣੀਆਂ ਨੇ ਮੈਂ ਪੜ੍ਹਦੀ ਆਂਗੀ ਅਤੇ ਇਹ ਕੁਛ ਕੁ ਨੋਵਲ ਸੀਗੇ ਜਿਹੜੇ ਮੇਰੇ ਬਹੁਤ ਹੀ ਦਿਲਚਸਪ ਨੇ ਤੇ ਮੈਨੂੰ ਮਤਲਬ ਮੇਰੇ ਮਨਪਸੰਦ ਨੇ ਅਤੇ ਇਹਨਾਂ ਨੂੰ ਮੈਂ ਮਤਲਬ ਆਪਣੀ ਕਲੈਕਸ਼ਨ ਦੇ ਵਿੱਚ ਰੱਖਿਆ ਹੋਇਆ